ਪੰਜ ਅਕਤੂਬਰ ਉੱਨੀ ਸੌ ਸਤੱਤਰ ਦਸ ਦਸੰਬਰ ਦੋ ਹਜ਼ਾਰ ਗਿਆਰਾਂ ਸੋਲ੍ਹਾਂ ਜਨਵਰੀ ਉੱਨੀ ਸੌ ਇਕਿਆਸੀ ਨੌਂ ਅਗਸਤ ਉੱਨੀ ਸੌ ਅੱਸੀ ਛੱਬੀ ਜਨਵਰੀ ਦੋ ਹਜ਼ਾਰ ਤੇਈ